ਰੇਲ ਗੱਡੀ ਦਾ ਸਫ਼ਰ ਕਰਨਾ ਮੈਨੂੰ ਬਹੁਤ ਪਸੰਦ ਹੈ ਬ ਬੜੀ ਮੈਨੂੰ ਇੱਕ ਵਾਰ ਮੌਕਾ ਮਿਲਿਆ ਯਾਤਰਾ ਹਜ਼ੂਰ ਸਾਹਿਬ ਦੀ ਕਰਨ ਦਾ ਰੇਲ ਗੱਡੀ 'ਤੇ ਪਰ ਹੁਣ ਤਾਂ ਰੇਲ ਗੱਡੀ ਸਿੱਧੀ ਜਾਣ ਲੱਗ ਗਈ ਹਜ਼ੂਰ ਸਾਹਿਬ ਲਈ ਪਰ ਜਦੋਂ ਮੈਂ ਗਈ ਸੀ ਤਾਂ ਉਦੋਂ ਰੇਲ ਗੱਡੀ ਰਸਤੇ ਵਿੱਚ ਚੇਂਜ ਕਰਨੀ ਪੈਂਦੀ ਸੀ ਅਤੇ ਇੱਥੋਂ ਬੋਂਬੇ ਜਾਣਾ ਪੈਂਦਾ ਬੋਂਬੇ ਤੋਂ ਫਿਰ ਮਨਮਾੜ ਜਾਲਨਾ ਜਾਣਾ ਪੈਂਦਾ ਅਤੇ ਰੇਲ ਗੱਡੀ ਦਾ ਸਫ਼ਰ ਕਾਫ਼ੀ ਮੈਨੂੰ ਦੋ ਤਿੰਨ ਦਿਨ ਲਈ ਰੇਲ ਗੱਡੀ ਦੇ ਵਿੱਚ ਹੀ ਰਹਿਣਾ ਪਿਆ ਔਰ ਬੜਾ ਵਧੀਆ ਯਾਦਗਾਰ ਸਫ਼ਰ ਰਿਹਾ ਮੇਰਾ ਅਤੇ ਉਹਦੇ ਵਿੱਚ ਪਹਿਲਾਂ ਬੁਕਿੰਗ ਕਰਵਾਈ ਸੀਟਾਂ ਵਗੈਰਾ ਬਹੁਤ ਵਧੀਆ ਬੜੇ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਸਫ਼ਰ ਦੇ ਵਿੱਚ ਲੱਗਾ ਹੀ ਨਹੀਂ ਕਿ ਦੋ ਦਿਨ ਅਸੀਂ ਟ੍ਰੇਨ ਦੇ ਵਿੱਚ ਲੰਘਾ ਰਹੇ ਹਾਂ ਰੇਲ ਗੱਡੀ ਦੇ ਵਿੱਚ ਇੰਨਾ ਸਫ਼ਰ ਕਰ ਰਹੇ ਹਾਂ ਵੱਖਰੇ ਵੱਖਰੇ ਧਰਮਾਂ ਦੇ ਲੋਕ ਵਿੱਚ ਬੈਠੇ ਆ ਵਤ ਵੱਖਰੇ ਵੱਖਰੇ ਭਾਸ਼ਾਵਾਂ ਦੇ ਲੋਕ ਬੈਠੇ ਆ ਸਭ ਆਪਣੀ ਆਪਣੀ ਐਕਸਪੀਰੀਅੰਸ ਦੇ ਰਹੇ ਆ ਕੋਈ ਆਪਣੀ ਰੇਲ ਗੱਡੀ ਦੇ ਸਫ਼ਰ ਨੂੰ ਕਿਸੇ ਤਰ੍ਹਾਂ ਕੋਈ ਟੂਰਿਸਟ ਆਇਆ ਹੋਇਆ ਕੋਈ ਇੱਥੋਂ ਜਦੋਂ ਅੰਮ੍ਰਿਤਸਰ ਸਾਹਿਬ ਹੋ ਕੇ ਗਿਆ ਆਪਣੀ ਯਾਤਰਾ ਬਾਰੇ ਦੱਸ ਰਿਹਾ ਕਿ ਸਾਨੂੰ ਬਹੁਤ ਚੰਗਾ ਲੱਗਾ ਕਿਵੇਂ ਦਾ ਲੱਗਾ ਮੈਨੂੰ ਵੀ ਸੁਣਨਾ ਬੜਾ ਚੰਗਾ ਲੱਗਾ ਜਦੋਂ ਆਪਣੇ ਸ਼ਹਿਰ ਬਾਰੇ ਆਪਣੀ ਜਗ੍ਹਾ ਬਾਰੇ ਕੋਈ ਤਾਰੀਫ਼ ਕਰ ਰਿਹਾ ਹੋਵੇ ਤਾਂ ਉਹ ਸੁਣਨਾ ਹੋਰ ਜ਼ਿਆਦਾ ਚੰਗਾ ਲੱਗਦਾ ਹੈ ਅਤੇ ਇਸ ਤਰ੍ਹਾਂ ਹੀ ਮੈਨੂੰ ਸਫ਼ਰ ਦੇ ਵਿੱਚ ਜਾਣ ਦਾ ਬੜਾ ਅੱਛਾ ਮੌਕਾ ਮਿਲਿਆ ਰਾਤ ਦਾ ਸਫ਼ਰ ਸੀ ਟਰੇਨ ਦੇ ਵਿੱਚ ਸੀਟਾਂ ਵਗੈਰਾ ਬਹੁਤ ਵਧੀਆ ਸੀ ਏ ਸੀ ਬੁਕਿੰਗ ਕਰਵਾਈ ਸੀ ਅਤੇ ਸਾਰੀਆਂ ਫੈਸਿਲਿਟੀਆਂ ਉੱਥੇ ਖਾਣੇ ਦੀ ਪੂਰੀ ਫੈਸਿਲਿਟੀ ਸੀ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਬਰਥ ਵਗੈਰਾ ਬਹੁਤ ਵਧੀਆ ਸੀ ਹਾਂ ਟਰੇਨ ਦਾ ਇੰਜਨ ਦਾ ਸ਼ੋਰ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਇੰਨੀ ਸੋਹਣੀਆਂ ਮੈਮਰੀਸ ਜਦੋਂ ਬਣ ਰਹੀਆਂ ਹੋਣ ਤਾਂ ਇਹੋ ਜਿਹੇ ਸ਼ੋਰ ਸ਼ਰਾਬਾ ਖ਼ਰਾਬ ਵੀ ਨਹੀਂ ਕਰਦਾ ਸਫ਼ਰ ਨੂੰ ਬੜਾ ਅੱਛਾ ਲੱਗਾ ਜਦੋਂ ਪਰ ਇਹ ਹੈ ਕਿ ਟਰੇਨ 'ਤੇ ਜਾਣਾ ਜਰਾ ਟਾਈਮ ਘੱਟ ਲੱਗਦਾ ਹੈ ਕਿਰਾਇਆ ਵੀ ਚਲੋ ਥੋੜ੍ਹਾ ਜਿਹਾ ਠੀਕ ਆਪਣੀ ਪੋਕਿਟ ਨੂੰ ਵੇਖਦਿਆਂ ਹੋਇਆ ਠੀਕ ਰਹਿੰਦਾ ਹੈ ਅਤੇ ਘੁੰਮਣ ਦਾ ਜ਼ਿਆਦਾ ਮੌਕਾ ਲੱਗ ਜਾਂਦਾ ਅਤੇ ਬਹੁਤ